ਵੈਸੇ ਤਾਂ ਭਾਰਤ ਦੇ ਕਈ ਵੱਡੇ ਸ਼ਹਿਰ ਹੈ ਜਿਹਨਾਂ ਦੇ ਵਿੱਚ ਸਾਈਕਲਿੰਗ ਦੀ ਸੁਵਿਧਾ ਲੋਕਾਂ ਨੂੰ ਦਿੱਤੀ ਗਈ ਹੈ ਪਰ ਮੈਂ ਸਾਈਕਲਿੰਗ ਮੋਸਟਲੀ ਚੰਡੀਗੜ੍ਹ ਜੋ ਕਿ ਪੰਜਾਬ ਦੀ ਰਾਜਧਾਨੀ ਹੈ ਉੱਥੇ ਕੀਤੀ ਹੈ ਕਿਉਂਕਿ ਉੱਥੇ ਸਪੈਸ਼ਲ ਇੱਕ ਸਾਈਕਲਿੰਗ ਪਾਥ ਜੋ ਹੈ ਉਹ ਪਰੋਵਾਇਡ ਕੀਤਾ ਗਿਆ ਬਾਈਕ ਰਾਈਡਰਸ ਲਈ ਜਿੱਥੇ ਉਹ ਕਿਸੇ ਵੀ ਸੈਕਟਰ ਬਾਇ ਬਾਈਕ ਬਾਈਕਸਾਇਕਲ ਜਾ ਸਕਦੇ ਹੈ ਔਰ ਉੱਥੇ ਇਲੈਕਟਰੋਨਿਕ ਈ ਸਾਈਕਲਸ ਵੀ ਦੀ ਵੀ ਸੁਵਿਧਾ ਦਿੱਤੀ ਗਈ ਹੈ ਸੋ ਮੈਂ ਓਹ ਵਾਲੀ ਸਾਇਕਲਸ ਕਿ ਆਪਣੇ ਸ਼ਹਿਰ ਚੰਡੀਗੜ੍ਹ ਦੇ ਵਿੱਚ ਚਲਾਈਆਂ ਨੇ ਇਸ ਤੋਂ ਇਲਾਵਾ ਮੈਂ ਡੇਲੀ ਦੇ ਵਿੱਚ ਵੀ ਓਹ ਸਾਰੀ ਫੈਸਿਲਟੀਸ ਦੇਖੀਆਂ ਨੇ ਸੋ ਮੈਨੂੰ ਲੱਗਦਾ ਕਿ ਇਸ ਤੋਂ ਇਲਾਵਾ ਹੋਰ ਵੀ ਵੱਡੇ ਸ਼ਹਿਰ ਜਿਵੇਂ ਕੋਲਕੱਤਾ ਹੋ ਗਿਆ ਪੁਨੇ ਹੋ ਗਿਆ ਜਾਂ ਗੋਆ ਦੇ ਵਿੱਚ ਵੀ ਇਵੇਂ ਦੀਆਂ ਸਾਇਕਲਿੰਗ ਦੀਆਂ ਫੈਸਿਲਟੀਸ ਦਿੱਤੀਆਂ ਜਾਂਦੀਆਂ ਲੋਕਾਂ ਨੂੰ ਜਿੱਥੇ ਓਹ ਜਾ ਕੇ ਕੀ ਹੈ ਸਾਇਕਲਿੰਗ ਕਰ ਸਕ